ਚੌਦਾਂ ਫ਼ਰਵਰੀ ਦੋ ਹਜ਼ਾਰ ਦੋ ਸਤਾਈ ਅਗਸਤ ਉੱਨੀ ਸੌ ਉਣਾਨਵੇਂ ਚੌਵੀ ਅਗਸਤ ਉੱਨੀ ਸੌ ਦੋ ਪੰਦਰਾਂ ਜਨਵਰੀ ਦੋ ਹਜ਼ਾਰ ਇੱਕ ਦੋ ਫ਼ਰਵਰੀ ਦੋ ਹਜ਼ਾਰ ਅੱਠ